ਮੈਂ ਆਪਣੀ ਪਹਿਲੀ ਪ੍ਰੋਡਕਟ ਜੋ ਕਿ ਮੋਬਾਈਲ ਸੀ ਜੋ ਕਿ ਮੈਨੇ ਫਲਿੱਪਕਾਰਡ ਤੋਂ ਖਰੀਦਿਆ ਸੀ ਉਹਦੇ ਬਾਰੇ ਦੱਸਣਾ ਚਾਹਾਂਗਾ ਇਹ ਮੋਬਾਈਲ ਸੈਮਸੰਗ ਕੰਪਨੀ ਦਾ ਸੀ ਜੋ ਕਿ ਮੈਨੇ ਪੰਦਰਾਂ ਕੁ ਹਜ਼ਾਰ ਰੁਪਏ 'ਚ ਖਰੀਦਿਆ ਸੀ ਇਸ ਮੋਬਾਇਲ 'ਚ ਮੈਨੂੰ ਦਸ ਕੁ ਪਰਸੈਂਟ ਡਿਸਕਾਊਂਟ ਮਿਲਿਆ ਸੀ ਅਤੇ ਇਹ ਮੈਂ ਲਗਭਗ ਦਿਵਾਲੀ ਵਾਲੇ ਦਿਨ ਤੋਂ ਪੰਜ ਕੁ ਦਿਨ ਪਹਿਲਾਂ ਖਰੀਦਿਆ ਸੀ ਇਹ ਮੋਬਾਈਲ ਮੈਨੂੰ ਦੂਜੀ ਕੰਪਨੀ ਨਾਲ ਕੰਪੇਅਰ ਕਰਕੇ ਰਿਵਿਊ ਦੇਖ ਕੇ ਖਰੀਦਿਆ ਸੀ ਅਤੇ ਇਸ ਰੇਟ ਦੇ ਬੈਸਟ ਫੀਚਰ ਸਲੈਕਟ ਕੀਤੇ ਸਨ ਮੋਬਾਇਲ ਮੈਨੇ ਚਾਰ ਕੁ ਸਾਲ ਪਹਿਲਾਂ ਖਰੀਦਿਆ ਸੀ ਅਤੇ ਅਜੇ ਤੱਕ ਮੈਂ ਇਸ ਮੋਬਾਈਲ ਨੂੰ ਚਲਾ ਰਿਹਾ ਹੈਂ ਇਸਦੀ ਚਾਰ ਜੀ ਬੀ ਰੈਮ ਹੈ ਅਤੇ ਚੌਂਹਠ ਜੀ ਬੀ ਸਟੋਰੇਜ ਹੈ ਬੈਟਰੀ ਬੈਕਅੱਪ ਬਹੁਤ ਵਧੀਆ ਹੈ ਮੇਰਾ ਮੋਬਾਇਲ ਇੱਕ ਵਾਰ ਚਾਰਜ ਕਰਨ ਨਾਲ ਡੇਢ ਕੁ ਦੋ ਦਿਨ ਕੱਢ ਦਿੰਦਾ ਹੈ ਅਤੇ ਚਾਰਜਿੰਗ ਦਾ ਵਿਕਲਪ ਵੀ ਉਪਲਬਧ ਹੈ ਮੋਬਾਇਲ ਦਾ ਕੈਮਰਾ ਬਹੁਤ ਵਧੀਆ ਹੈ ਇਸ ਮੋਬਾਈਲ ਦੇ ਕੈਮਰੇ ਵਿੱਚ ਪੋਟਰੇਟ ਦਾ ਫੀਚਰ ਵੀ ਹੈ ਅਤੇ ਇਸਦਾ ਚੌਂਹਠ ਮੈਂਗਾਪਿਕਸਲ ਦਾ ਕੈਮਰਾ ਬਹੁਤ ਹੀ ਵਧੀਆ ਫੋਟੋ ਖਿੱਚਦਾ ਹੈ ਇਹ ਮੋਬਾਈਲ ਕਦੇ ਵੀ ਹੈਂਗ ਨਹੀਂ ਹੁੰਦਾ ਹੈ ਇਸ ਮੋਬਾਈਲ 'ਚ ਕਾਫੀ ਚੰਗੇ ਫੀਚਰ ਹਨ ਜਿਵੇਂ ਕਿ ਐਪ ਲੋਕ ਫੇਸ ਲੋਕ ਬਾਇਓਮੈਟ੍ਰਿਕ ਫਿੰਗਰ ਸਕੈਨ ਦੋ ਸਾਲ ਲੋਕਡਾਊਨ ਦੇ ਵਿੱਚ ਮੈਂ ਆਪਣੀ ਬੇਟੀ ਨੂੰ ਇਸ ਮੋਬਾਇਲ 'ਚ ਔਨਲਾਈਨ ਕਲਾਸਾਂ ਵੀ ਲਗਵਾਈਆਂ ਸਨ ਅਤੇ ਉਸਦਾ ਸਾਰਾ ਕੰਮ ਜੋ ਕਿ ਸਕੂਲ ਦਾ ਹੁੰਦਾ ਸੀ ਇਸ ਮੋਬਾਈਲ ਨਾਲ ਹੀ ਅਸੀਂ ਮੇਰੀ ਬੇਟੀ ਇਸਨੂੰ ਪੂਰਾ ਕਰਦੀ ਸੀ ਇਹ ਮੋਬਾਈਲ ਮੇਰਾ ਬੇਟਾ ਵੀ ਵਰਤਦਾ ਹੈ ਉਹ ਇਸ ਮੋਬਾਈਲ ਵਿੱਚ ਕਾਫੀ ਸਾਰੀ ਗੇਮਾਂ ਖੇਡਦਾ ਹੈ ਜਿਵੇਂ ਕਿ ਟੋਕਿੰਗ ਟੌਮ ਕੈਂਡੀ ਕ ਕਰਸ਼ ਇਸ ਮੋਬਾਈਲ ਵਿੱਚ ਅਸੀਂ ਫੈਮਲੀ ਦਾ ਵਟਸਐਪ ਗਰੁੱਪ ਬਣਾਇਆ ਹੋਇਆ ਹੈ ਇੱਕ ਦੂਜੇ ਨੂੰ ਤਿਉਹਾਰਾਂ 'ਤੇ ਵੀਡਿਓ ਕੌਲ ਕਰਦੇ ਹਾਂ ਅਤੇ ਔਨਲਾਈਨ ਚੈਟਿੰਗ ਕਰਦੇ ਹਾਂ ਅਤੇ ਉਹਨਾਂ ਨੂੰ ਸੰਦੇਸ਼ ਵੀ ਭੇਜਦੇ ਹਾਂ ਇਸ ਤਰ੍ਹਾਂ ਇਸ ਮੋਬਾਈਲ ਨੂੰ ਆਪਣੇ ਫੈਮਲੀ ਵਿੱਚ ਆਪਣੇ ਪਰਿਵਾਰ ਵਿੱਚ ਇੱਕ ਦੂਜੇ ਨਾਲ ਗੱਲਬਾਤ ਕਰਨ ਦਾ ਸਾਧਨ ਬਣਾਇਆ ਹੋਇਆ ਹੈ